ਪੰਜਾਬ ਦੇ ਰਵਾਇਤ ਫੈਸ਼ਨ ਅਤੇ ਸਟਾਈਲ ਦੇ ਵਿੱਚ ਸਭ ਤੋਂ ਉੱਪਰ ਹੈ ਕੁੜੀਆਂ ਦਾ ਸੂਟ ਸਲਵਾਰ ਅਤੇ ਪਰਾਂਦਾ ਅਤੇ ਮੁੰਡਿਆਂ ਦਾ ਹੈ ਪੱਗ ਕੁੜਤਾ ਅਤੇ ਧੋਤੀ ਜੋ ਉਹਨਾਂ ਨੂੰ ਇੱਕ ਅਲੱਗ ਹੀ ਰੂਪ ਦਿੰਦਾ ਹੈ ਅਤੇ ਇਹ ਇੱਕ ਭਾਈਚਾਰੇ ਦਾ ਵੀ ਭਾਈਚਾਰੇ ਦਾ ਵੀ ਸਿੰਬਲ ਹੈ